ਅਧਿਆਪਨ ਵਿਧੀ ਜੇ ਆਪਾਂ ਦੇਖੀਏ ਤਾਂ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਇੰਮਪਰੂਵਮੈਂਟ ਹੋਈਆਂ ਨੇ ਬਟ ਅਜੇ ਵੀ ਆ ਜਿਹੜੀਆਂ ਕੁਛ ਚੀਜ਼ਾਂ ਨੇ ਜਿਹੜੀਆਂ ਅਜੇ ਕਰਨ ਵਾਲੀਆਂ ਰਹਿ ਰਹੀਆਂ ਨੇ ਜਿਹੜੇ ਕਿ ਪਿੰਡਾਂ ਦੇ ਵਿੱਚ ਅਜੇ ਵੀ ਕਾਫੀ ਸਾਰੇ ਜਿਹੜੇ ਬੱਚੇ ਆ ਉਹ ਚੈਲੇਜ ਫੇਸ ਕਰ ਰਹੇ ਆ ਜਿਵੇਂ ਕਿ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਲਗਾ ਲਈਏ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਪ੍ਰਾਈਵੇਟ ਸਕੂਲਾਂ ਦੇ ਕੰਪੈਰੀਜ਼ਨ ਬਹੁਤ ਜ਼ਿਆਦਾ ਵੀਕ ਹੁੰਦੀ ਹੈ ਅਤੇ ਜਿਹੜੀ ਇਸ ਦੇ ਵਿੱਚ ਹੈ ਕਿ ਪਿੰਡਾਂ ਦੇ ਵਿੱਚ ਵੀ ਜਿਵੇਂ ਕਿ ਜਿਹੜੇ ਆਪਣੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੋਚਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਪਹਿਲਾਂ ਹੀ ਉਹਨਾਂ ਨੂੰ ਕੰਪੀਟੀਸ਼ਨ ਦੇ ਲਈ ਨੌਵੀਂ ਜਾਂ ਦਸਵੀਂ ਕਲਾਸ ਤੋਂ ਹੀ ਤਿਆਰ ਕੀਤਾ ਜਾਂਦਾ ਉਵੇਂ ਹੀ ਪਿੰਡਾਂ ਦੇ ਵਿੱਚ ਜਿਹੜੀ ਬੱਚਿਆਂ ਨੂੰ ਜਿਹੜੀ ਕੋਚਿੰਗ ਹੈ ਉਹ ਪ੍ਰੋਵਾਈਡ ਕੀਤੀ ਜਾ ਜਾ ਜਾਵੇ ਤਾਂ ਕਿ ਜਿਹੜੇ ਉਹ ਬੱਚੇ ਨੇ ਉਹ ਸ਼ਹਿਰੀ ਬੱਚਿਆਂ ਦੇ ਨਾਲ ਕੰਪੀਟੀਸ਼ਨ ਲੜ ਸਕਣ ਉਹਨਾਂ ਦੇ ਵਿੱਚ ਪਿੰਡਾਂ ਦੇ ਬੱਚਿਆਂ ਦੇ ਵਿੱਚ ਵੀ ਓਨਾ ਕੋਂਨਫੀਡੈਂਸ ਆਵੇ ਜਿੰਨਾ ਕਿ ਸ਼ਹਿਰੀ ਬੱਚਿਆਂ ਦੇ ਵਿੱਚ ਹੈ